ਪੰਜਾਬ ਵਿੱਚ ਮੁੱਖ ਧਾਰਮਿਕ ਸਥਾਨ ਹਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਚਮਕੌਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਹ ਸਾਰੇ ਸਥਾਨਾਂ ਦੀ ਆਪਣੀ ਇਕ ਧਾਰਮਿਕ ਮਾਨਤਾ ਹੈ ਦੂਰੋਂ ਦੂਰੋਂ ਲੋਕ ਇਨ੍ਹਾਂ ਧਰ ਧਾਰਮਿਕ ਸਥਾਨਾਂ 'ਤੇ ਆਪਣਾ ਮੱਥਾ ਟੇਕਣ ਆਉਂਦੇ ਹਨ ਅਤੇ ਹਰ ਇੱਕ ਧਰਮ ਅਤੇ ਜਾਤੀ ਦੇ ਲੋਕ ਇੱਥੇ ਆ ਕੇ ਇਨ੍ਹਾਂ ਸਥਾਨਾਂ ਵਿੱਚ ਆਪਣਾ ਪੂਜਾ ਪਾਠ ਕਰਦੇ ਹਨ ਅਤੇ ਆਪਣੀ ਹਰ ਇੱਕ ਮਨੋਕਾਮਨਾ ਲਈ ਦੁਆਵਾਂ ਮੰਗਦੇ ਹਨ ਅਤੇ ਜੋ ਕਿ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ